ਮੈਂ ਸੰਪਾਦਨ ਅਤੇ ਸੰਸ਼ੋਧਨਾ ਨੂੰ ਲਿਖਦੇ ਸਮੇਂ ਹਰ ਵਾਰ ਵੈਸੇ ਸੰਭਾਲ ਹੀ ਲੈਨਾ ਵੈਸੇ ਮੇਰੇ ਕੋਲ ਕੋਈ ਖਾਸ ਪ੍ਰਤੀ ਪ੍ਰਤੀਕਿਰਿਆ ਤਾਂ ਨਹੀਂ ਹੈਗੀ ਹੈ ਨਾ ਪਰ ਜਦੋਂ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਤਾਂ ਮੈਂ ਇੰਟਰਨੈਟ ਦੀ ਮਦਦ ਲੈ ਲੈਂਦਾ ਹੁੰਦਾ ਵੈਸੇ ਤਾਂ ਮੈਂ ਕਿਤਾਬਾਂ ਨਿਊਜ਼ਪੇਪਰ ਜਾਂ ਹੋਰ ਕੁਝ ਵੀ ਮਿਲਦਾ ਮੈਨੂੰ ਪੜ੍ਹਨ ਵਾਲਾ ਤਾਂ ਮੈਂ ਪੜ੍ਹਦਾ ਹੀ ਰਹਿਨਾ ਅਤੇ ਜਦੋਂ ਮੈਨੂੰ ਕਿਤਾਬਾਂ ਜਾਂ ਕੁਝ ਉਹਦੇ 'ਚੋਂ ਵੀ ਨਹੀਂ ਸਮਝ ਆਉਂਦਾ ਜਾਂ ਫਿਰ ਮੈਂ ਇੰਟਰਨੈਟ ਦੀ ਮਦਦ ਇੰਟਰਨੈਟ ਤੋਂ ਸਭ ਕੁਝ ਮਿਲੀ ਜਾਂਦਾ ਹੈ ਨਾ ਅਤੇ ਕਈ ਵਾਰ ਮੈਨੂੰ ਪੜ੍ਹਨ ਤੋਂ ਜਦੋਂ ਕਿਤਾਬ ਜਾਂ ਕੁਝ ਹੋਰ ਨਹੀਂ ਮਿਲਦਾ ਤਾਂ ਮੈਂ ਇੰਟਰਨੈਟ 'ਤੇ ਵੀ ਪੜ੍ਹ ਲੈਂਦਾ ਹੁੰਦਾ ਕੁਝ ਨਾ ਕੁਝ ਕੱਢ ਕੇ ਜੋ ਦਿਲ ਕਰਦਾ ਹੁੰਦਾ ਅਤੇ ਮੇਰੇ ਦਿਮਾਗ 'ਚ ਵੈਸੇ ਤਾਂ ਤਰੀਕੇ ਨਵੇਂ ਨਵੇਂ ਲਿਖਣ ਦੇ ਆਉਂਦੇ ਹੀ ਰਹਿੰਦੇ ਨੇ ਨਵਾਂ ਕੁਝ ਨਾ ਕੁਝ ਲਿਖਦਾ ਹੀ ਰਹਿੰਦਾ ਮੈਂ ਅਤੇ ਜਦੋਂ ਮੈਂ ਲਿਖਦਾ ਹੁੰਨਾ ਤਾਂ ਆਪਣੇ ਆਪ ਪਰਵਾਹ ਹੁੰਦਾ ਮੇਰੀ ਲਿਖਤ 'ਚ ਆਪਣੇ ਆਪ ਫਲੋ ਆਉਂਦਾ ਲਿਖਤ 'ਚ ਅਤੇ ਫਿਰ ਲਿਖਣ ਦੇ ਨਾਲ ਸਰੂਰ ਜਿਹਾ ਚੜਿਆ ਰਹਿੰਦਾ ਅਤੇ ਲਿਖੀ ਜਾਂਦੇ ਹੁੰਦੇ ਆ ਜੋ ਵੀ ਦਿਮਾਗ 'ਚ ਆਉਂਦਾ ਵਧੀਆ ਤੋਂ ਵਧੀਆ ਲਿਖਣ ਦੀ ਕੋਸ਼ਿਸ਼ ਕਰਦੇ ਹਾਂ